ਮੈਂ ਜਦੋਂ ਨਵੀਂ ਕਾਰ ਲੈਣੀ ਸੀ ਤਾਂ ਮੈਂ ਸਾਡੇ ਨਾਲ ਲੱਗਦੇ ਬੈਂਕ ਐਸਬੀਆਈ ਤੋਂ ਲੋਨ ਕਰਵਾਇਆ ਕਿਉਂਕਿ ਮੇਰੇ ਪਾਸ ਇੰਨੇ ਪੈਸੇ ਨਹੀਂ ਸੀ ਕਿ ਮੈਂ ਮੈਂ ਉਹ ਕਾਰ ਖਰੀਦ ਸਕਾਂ ਕੁਛ ਪੈਸੇ ਸੀ ਕੁਛ ਜਿੰਨੇ ਮੈਨੂੰ ਚਾਹੀਦੇ ਸੀ ਉੱਨੇ ਪੈਸੇ ਮੇਰੇ ਕੋਲ ਨਹੀਂ ਸੀ ਲੋਨ ਮੈਨੂੰ ਥੋੜ੍ਹਾ ਕਰਾਉਣਾ ਪਿਆ ਜਿਸ ਦੇ ਕਾਰਨ ਫਿਰ ਮੈਂ ਉਹ ਗੱਡੀ ਲੈ ਸਕਿਆ